ਭਾਰਤ ਵਿੱਚ ਜੇ ਸਿਹਤ ਸੰਭਾਲ ਪ੍ਰਣਾਲੀ ਦੀ ਗੱਲ ਕੀਤੀ ਜਾਵੇ ਤਾਂ ਵੱਖੋ ਵੱਖਰੇ ਰਾਜਿਆਂ 'ਚ 'ਚ ਵੱਖਰੀ ਵੱਖਰੀ ਹੈ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਜਿੱਥੋਂ ਦਾ ਮੈਂ ਨਿਵਾਸੀ ਹਾਂ ਐਥੇ ਵੀ ਮਤਲਬ ਕਾਫੀ ਟਾਈਮ 'ਤੇ ਕਾਫੀ ਲੰਮੀਆਂ ਕਤਾਰਾਂ ਵਿੱਚ ਲੱਗ ਕੇ ਨੰਬਰ ਆਉਂਦਾ ਹੈ ਅਤੇ ਅਤੇ ਕਾਫੀ ਘੱਟ ਹੋਸਪਿਟਲਜ਼ ਨੇ ਇੱਥੇ ਜੋ ਕਿ ਇਲਾਜ ਕਰਦੇ ਨੇ ਕਿਸੇ ਸਪੈਸੀਫਿਕ ਬਿਮਾਰੀ ਦਾ ਜਾਂ ਕਿਸੇ ਸਪੈਸੀਫਿਕ ਰੋਗ ਦਾ ਅਤੇ ਜੇਕਰ ਵੱਡੇ ਪੱਧਰ 'ਤੇ ਦੇਖਿਆ ਜਾਵੇ ਜਿੱਦਾਂ ਵੱਖ ਵੱਖ ਰਾਜਿਆਂ ਵਿੱਚ ਅਤੇ ਜਾਂ ਵੱਡੇ ਪੱਧਰ 'ਤੇ ਦੇਖਿਆ ਜਾਵੇ ਦੇਸ਼ ਦੇ ਤੌਰ 'ਤੇ ਤਾਂ ਹਜੇ ਵੀ ਅਸੀਂ ਕਾਫੀ ਪਿੱਛੇ ਚੱਲ ਰਹੇ ਹਾਂ ਕਾਫੀ ਆਧੁਨਿਕ ਗਤੀਵਿਧੀਆਂ ਅਤੇ ਤਕਨੀਕਾਂ 'ਚ ਜੋ ਕਿ ਵੱਖਰੇ ਵੱਖਰੇ ਦੇਸ਼ਾਂ ਨੇ ਲਗਾ ਚੁੱਕੇ ਹਨ ਆਪਣੇ ਸਿਹਤ ਸੰਭਾਲ ਪ੍ਰਣਾਲੀ ਵਿੱਚ ਅਤੇ ਇਹ ਚੀਜ਼ ਦਾ ਵੀ ਮਤਲਬ ਹੀਲਾ ਆ ਰਿਹਾ ਅਤੇ ਕਾਫੀ ਦੇਸ਼ ਅਤੇ ਕਾਫੀ ਸਾਇੰਟਿਸਟ ਅਤੇ ਉਹ ਰਿਸਰਚ ਹੋ ਰਹੀ ਇਹਨਾਂ ਚੀਜ਼ਾਂ 'ਤੇ ਅਤੇ ਕਾਫੀ ਵਧੀਆ ਅਤੇ ਸੁਧਾਰ ਆਉਣ ਦੀ ਮਤਲਬ ਸੰਭਾਵਨਾ ਹੈਗੀ ਆ ਆਪਣੇ ਦੇਸ਼ ਵਿੱਚ ਵੀ ਅਤੇ ਜਿੰਨੇ ਕੁ ਮੇਰੇ ਦੋਸਤ ਮੈਨੂੰ ਦੱਸਦੇ ਕੈਨੇਡਾ ਵਗੈਰਾ ਜਾਂ ਕੁਛ ਹੋਰ ਦੇਸ਼ ਜੋ ਕਿ ਨੇ ਜਿੱਥੇ ਕਾਫੀ ਇਮੀਗ੍ਰੇਸ਼ਨ ਹੁੰਦੀ ਹੈ ਅਤੇ ਉੱਥੇ ਵੀ ਕਾਫੀ ਕਹਿੰਦੀ ਕਿ ਫੈਸਲਿਟੀਜ਼ ਜੋ ਕਿ ਮੈਡੀਕਲ ਫੈਸਿਲਿਟੀਜ਼ ਕਾਫੀ ਘੱਟ ਨੇ ਅਤੇ ਕਾਫੀ ਲੰਬੀਆਂ ਕਤਾਰਾਂ 'ਚ ਲੱਗਣਾ ਪੈਣਾ ਜੋ ਕਿ ਮੈਂ ਇੱਕ ਵੱਡੀ ਉਪ ਉਪਾਧੀ ਦੇਖਦਾ ਕਿ ਸਾਡੇ ਪੰਜਾਬ ਦੇ ਵੱ ਬਾਕੀ ਦੇਸ਼ਾਂ ਨੇ ਕਾਫੀ ਤਰੱਕੀ ਕੀਤੀ ਹੋਈ ਹੈ ਅਤੇ ਇਹ ਚੀਜ਼ ਕਾਫੀ ਵਧੀਆ ਅਤੇ ਚੰਗੀ ਲੱਗੀ ਹੈ ਮੈਨੂੰ ਅਤੇ ਮੈਂ ਚਾਹੁੰਦਾ ਕਿ ਹੋਰ ਇੱਦਾਂ ਹੀ ਅੱਗੇ ਅੱਗੇ ਵਧਦੇ ਜਾਣ ਅਤੇ ਤਰੱਕੀ ਕਰਦੇ ਜਾਣ ਆਪਣੀ ਸਿਹਤ ਸੰਭਾਲ ਪ੍ਰਣਾਲੀ